ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਰੈਸਟੋਰੈਂਟ ਖੁੱਲ੍ਹਾ ਹੈ ਜਾਂ ਬੰਦ ਹੈ ਅਗਰ ਖੁੱਲ੍ਹਾ ਹੈ ਤਾਂ ਕਿਰਪਾ ਕਰਕੇ ਮੇਰਾ ਔਡਰ ਨੋਟ ਕੀਤਾ ਜਾਵੇ ਮੇਰੇ ਘਰ ਗੈਸਟ ਆਉਣੇ ਹਨ ਸੋ ਉਹਨਾਂ ਵਾਸਤੇ ਸ਼ਾਹੀ ਪਨੀਰ ਪਾਲਕ ਪਨੀਰ ਅਤੇ ਬਟਰ ਵਾਲੇ ਨਾਨ ਵਾਲੀ ਰੋਟੀ ਅਤੇ ਇੱਕ ਕੜੀ ਇਹ ਤਿੰਨ ਆਈਟਮਾਂ ਅਤੇ ਚੌਥੀ ਰੋਟੀ ਇਹ ਭੇਜ ਦਿੱਤੀਆਂ ਜਾਣ ਅਤੇ ਮੈਨੂੰ ਦੱਸਿਆ ਵੀ ਜਾਵੇ ਕਿ ਕੀ ਤੁਸੀਂ ਕੈਸ਼ ਔਨ ਡਿਲੀਵਰੀ ਦਿੰਦੇ ਹੋ ਅਗਰ ਨਹੀਂ ਤਾਂ ਫਿਰ ਮੈਂ ਗੂਗਲ ਪੇ ਕਰਕੇ ਜਿਹੜਾ ਹੈ ਉਹ ਤੁਹਾਡੇ ਤੋਂ ਜਿਹੜਾ ਖਾਣਾ ਹੈ ਉਹ ਮੰਗਵਾ ਲਵਾਂ ਧੰਨਵਾਦ